ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਦਿਲਚਸਪ ਸ਼ਬਦ ਹਨ ਜਿਨ੍ਹਾਂ ਨੂੰ ਪੜ੍ਹ ਕੇ ਜਾਂ ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਵੇਂ ਕਿ ਮੈਂ ਵਾਹਿਗੁਰੂ ਸ਼ਬਦ ਦਾ ਬਹੁਤ ਹੀ ਉਚਾਰਣ ਕਰਦਾ ਹਾਂ ਅਤੇ ਸਵੇਰ ਨੂੰ ਮੈਂ ਇਸ ਸ਼ਬਦ ਨੂੰ ਜਪ ਕੇ ਆਪਣੇ ਆਪ ਨੂੰ ਬਹੁਤ ਹੀ ਰਿਲੈਕਸ ਫ਼ੀਲ ਵੀ ਕਰਦਾ ਹਾਂ ਅਤੇ ਜਦੋਂ ਵੀ ਮੈਂ ਛਿੱਕ ਮਾਰਦਾ ਹਾਂ ਅਤੇ ਮੇਰੇ ਮੂੰਹੋਂ ਆਪਣੇ ਆਪ ਵਾਹਿਗੁਰੂ ਸ਼ਬਦ ਦਾ ਉਚਾਰਣ ਹੋ ਜਾਂਦਾ ਹੈ ਅਤੇ ਵਾਕੰਸ਼ ਵੀ ਬਹੁਤ ਹਨ ਜਿਵੇਂ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਹ ਵਾਕੰਸ਼ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਤੇ ਇਸ ਤੋਂ ਸਾਨੂੰ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਕਿ ਤੀਰਥਾਂ ਉੱਤੇ ਨਹਾਉਣ ਨਾਲ ਕੁਛ ਨਹੀਂ ਹੁੰਦਾ ਸਾਨੂੰ ਜੋ ਵੀ ਕਰਨਾ ਚਾਹੀਦਾ ਹੈ ਆਪਣੇ ਮਨ ਨੂੰ ਸ਼ਾਂਤੀ ਦੇ ਕੇ ਕਰਨਾ ਚਾਹੀਦਾ ਹੈ